ਵੈਸੇ ਮੈਨੂੰ ਖਾਣ ਪੀਣ ਦਾ ਬਹੁਤ ਸ਼ੌਂਕ ਹੈ ਪਰ ਮੈਨੂੰ ਇਡਲੀ ਡੋਸਾ ਖਾਣਾ ਬਹੁਤ ਪਸੰਦ ਹੈ ਇਹ ਇੱਕ ਦੱਖਣੀ ਪੂਰਬੀ ਡਿਸ਼ ਹੈ ਮੈਂ ਇਸਨੂੰ ਗਨੇਸ਼ ਭੋਜਨ ਭੰਡਾਰ ਜੋ ਸਾਡੇ ਇਲਾਕੇ ਵਿੱਚ ਸਥਿਤ ਹੈ ਉੱਥੇ ਜਾ ਕੇ ਖਾਣਾ ਪਸੰਦ ਕਰਦਾ ਹਾਂ ਕਿਉਂਕਿ ਉਹਨਾਂ ਦੇ ਡੋਸੇ ਦਾ ਸਵਾਦ ਬਹੁਤ ਹੀ ਅਲੱਗ ਹੈ ਜੋ ਕਿ ਮੈਨੂੰ ਖਾਣ ਲਈ ਬਹੁਤ ਵਧੀਆ ਲੱਗਦਾ ਹੈ ਅਤੇ ਅਕਸਰ ਮੈਂ ਆਪਣੇ ਪਰਿਵਾਰ ਨਾਲ਼ ਜਾ ਕੇ ਖਾਂਦਾ ਹਾਂ